ਮੈਨੂੰ ਫੋਟੋ ਖਿੱਚਣ ਦਾ ਬਹੁਤ ਸ਼ੌਂਕ ਹੈ ਤਕਰੀਬਨ ਮੇਰੀ ਉਮਰ ਪੱਚੀ ਸਾਲ ਦੀ ਸੀ ਜਦੋਂ ਮੈਂ ਉਸ ਟਾਈਮ ਚੱਲ ਰਿਹਾ ਮੋਬਾਈਲ ਛਿਆਹਠ ਸੌ ਲਿਆ ਸੀ ਮੈਂ ਮੋਬਾਈਲ ਲੈ ਕੇ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਮੈਂ ਦਰਬਾਰ ਸਾਹਿਬ ਜਦੋਂ ਮੱਥਾ ਟੇਕਿਆ ਮੈਂ ਉਸ ਦੇ ਅੰਦਰ ਹੀ ਅੰਦਰੂਨੀ ਦ੍ਰਿਸ਼ ਦੀ ਸਾਰੀ ਫੋਟੋ ਆਪਣੇ ਮੋਬਾਇਲ ਦੇ ਕੈਮਰੇ ਵਿੱਚ ਕੈਦ ਕੀਤੀ ਉਸ ਫੋਟੋ ਤੋਂ ਕਾਫੀ ਟਾਈਮ ਤੱਕ ਮੈਂ ਸਕਰੀਨ ਸੇਵਰ ਵੀ ਆਪਣੇ ਗੁਰੂ ਗੁਰ ਕੈਮਰੇ 'ਚ ਲਗਾ ਕੇ ਰੱਖਿਆ ਮੈਂ ਜਗ੍ਹਾ ਜਗ੍ਹਾ ਉਸ ਤੋਂ ਬਾਅਦ ਮੈਂ ਪਹਾੜੀ ਇਲਾਕੇ ਵਿੱਚ ਘੁੰਮਣ ਗਿਆ ਪਹਾੜੀ ਇਲਾਕੇ ਦੀਆਂ ਬਹੁਤ ਫੋਟੋਆਂ ਖਿੱਚੀਆਂ ਉਸ ਤੋਂ ਬਾਅਦ ਮੈਂ ਹਿਲ ਸਟੇਸ਼ਨ 'ਤੇ ਘੁੰਮਣ ਗਿਆ ਹੇਮਕੁੰਡ ਸਾਹਿਬ ਦੇ ਵਿੱਚ ਉੱਥੇ ਬਰਫ ਨਾਲ ਢਕੀ ਇੱਕ ਲਹਿਰ ਦੀ ਵੀਡੀਓ ਵੀ ਬਣਾਈ ਅਤੇ ਬਹੁਤ ਫੋਟੋ ਖਿੱਚੀਆਂ ਉਹ ਅੱਜ ਤੱਕ ਫੋਟੋ ਸਾਡੇ ਕੋਲ ਕੁਛ ਫੋਟੋਆਂ ਸੰਭਾਲ ਕੇ ਰੱਖੀਆਂ ਗਈਆਂ ਹਨ